ਹੈਲੋ ਨਮਸਕਾਰ ਜੀ ਵੇਦ ਪ੍ਰਕਾਸ਼ ਦੀ ਗੱਲ ਕਰ ਰਹੇ ਹੋ ਸਰ ਮੈਂ ਚੰਦਨ ਕਾਡਾ ਬੋਲ ਰਿਹਾ ਮੈਂ ਦਿੱਲੀ ਦਾ ਰਹਿਣ ਵਾਲਾ ਮੇਰੇ ਖਿਆਲ ਤੁਸੀਂ ਟੁਰਿਸਟ ਗਾਈਡ ਹੈਗੀ ਆ ਹਨਾ ਇਸ ਟਾਈਮ ਸਰ ਫਾਜ਼ਿਲਕਾ ਜੀ ਫਾਜ਼ਿਲਕਾ ਦੇ ਹੋ ਨਾ ਤੁਸੀਂ ਸਰ ਐਕਚੁਲੀ ਮੈਂ ਕੱਲ ਫਾਜ਼ਿਲਕਾ ਵਿਜਿਟ ਕਰਨਾ ਮੈਂ ਸਵੇਰੇ ਇਥੇ ਪਹੁੰਚ ਜਗਾ ਅਰਾਊਂਡ ਮੈਂ ਪੰਜਾਬ ਮੇਲ ਤੇ ਆ ਰਿਹਾ ਤੇ ਮੈਂ ਪਹੁੰਚ ਜਾਗਾ ਫਾਜ਼ਿਲਕਾ ਰਾਉਂਡ ਸਵੇਰੇ ਸੱਤ ਸਾਢੇ ਸੱਤ ਵਜੇ ਹਾਂਜੀ ਤੇ ਮੈਂ ਇਹੀ ਗੱਲ ਕਰਨਾ ਫਾਜ਼ਿਲਕਾ ਚ ਘੁੰਮਣ ਦੀਆਂ ਜਾਂ ਦੇਖਣ ਲਾਇਕ ਕਿਹੜੇ ਕਿਹੜੇ ਜਗ੍ਹਾ ਹੈਗੀ ਹਾਂਜੀ ਹਾਂਜੀ ਠੀਕ ਐ ਕਿਸ ਤਰ੍ਹਾਂ ਦੀ ਜਗ੍ਹਾ ਹੈਗੀ ਐ ਸਰ ਘੁੰਮਣ ਲਈ ਠੀਕ ਐ ਠੀਕ ਐ

ਠੀਕ ਐ ਠੀਕ ਐ ਠੀਕ ਐ ਠੀਕ ਐ ਸਰ ਬਸ ਬਸ ਗੱਲ ਪਹੁੰਚਦਾ ਤਿੰਨ ਜਣੇ ਨੇ ਸਰ